ਪੰਜਾਬ ਵਿੱਚ ਬਹੁਤ ਸਾਰੇ ਉਦਯੋਗ ਜਾਂ ਸੈਕਟਰ ਹਨ ਜੋ ਰਾਜ ਦੀ ਆਰਥਿਕਤਾ ਵਿੱਚ ਯੋਗਦਾਨ ਪਾਉਂਦੇ ਹਨ ਟਾਟਾ ਵਰਗੇ ਇੱਕ ਬੜੀ ਵਧੀਆ ਕੰਪਨੀ ਹੈਗੀ ਹੈ ਜੋ ਕਿ ਲੋਕਾਂ ਦੀ ਮਦਦ ਕਰਨਾ ਆਪਣਾ ਇੱਕ ਸੁਭਾਵ ਆਪਣੀ ਇੱਕ ਜ਼ਰੂਰਤ ਮੰਨਦੀ ਹੈ ਉਹ ਹਰ ਵਾਰ ਜੋ ਵੀ ਆਪਣਾ ਮੁਨਾਫ਼ਾ ਕਮਾਉਂਦੀ ਹੈ ਉਸਦਾ ਸੱਠ ਪ੍ਰਤੀਸ਼ਤ ਉਹ ਲੋਕਾਂ ਵਿੱਚ ਦਾਨ ਕਰਦੀ ਹੈ ਰਾਜ ਦੀ ਆਰਥਿਕਤਾ ਵਿੱਚ ਯੋਗਦਾਨ ਪਾਉਂਦੀ ਹੈ ਸ਼ੂਗਰ ਵਰਗੀ ਕੰਪਨੀਆਂ ਡਾਬਰ ਇੰਡੀਆ ਵਗਰੀ ਕੰਪਨੀਆਂ ਇਲੈਕਟ੍ਰੋਨਿਕਸ ਇੰਡੀਆ ਪ੍ਰਾਈਵੇਟ ਲਿਮਿਟਡ ਵਰਗੀ ਕੰਪਨੀਆਂ ਇਹ ਸਭ ਮਦਦ ਕਰਦੀਆਂ ਹਨ ਗਵਰਮੈਂਟ ਵੀ ਖੇਤੀਬਾੜੀ ਕਰਨ ਵਾਲਿਆਂ ਨੂੰ ਬਹੁਤ ਸਾਰੀ ਆਰਥਿਕਤਾ ਵਿੱਚ ਯੋਗਦਾਨ ਦਿੰਦੇ ਹਨ ਉਹ ਉਨ੍ਹਾਂ ਨੂੰ ਆਰਥਿਕਤਾ ਵਲੋਂ ਉਨ੍ਹਾਂ ਦੀ ਮਸ਼ੀਨਾਂ ਵਲੋਂ ਬਹੁਤ ਸਾਰੀਆਂ ਮਦਦ ਪ੍ਰਦ ਪਾਉਂਦੇ ਹਨ ਯੋਗਦਾਨ ਦਿੰਦੇ ਹਨ ਕਿਉਂਕਿ ਗਵਰਮੈਂਟ ਚਾਹੁੰਦੀ ਹੈ ਕਿ ਖੇਤੀਬਾੜੀ ਨਿਰਮਾਨ ਸੇਵਾ ਜ਼ਿਆਦਾ ਤੋਂ ਜ਼ਿਆਦਾ ਵਧਣ ਅਤੇ ਪੰਜਾਬ ਦੀ ਜ਼ਿਆਦਾ ਤੋਂ ਜ਼ਿਆਦਾ ਡਵੈਲਪਮੈਂਟ ਹੋਵੇ ਉਹ ਚਾਹੁੰਦੇ ਹਨ ਕਿ ਆਰਥਿਕਤਾ ਵਿੱਚ ਪੰਜਾਬ ਬਹੁਤ ਵਧੀਆ ਖੜ੍ਹਾ ਹੋਵੇ ਅਤੇ ਸਾਰਿਆਂ ਨੂੰ ਇੱਕ ਟੱਕਰ ਦੇਵੇ ਇਸ ਲਈ ਉਦਯੋਗ ਜਾਂ ਸੈਕਟਰ ਬੜੀ ਮਦਦ ਕਰਦੇ ਹਨ